ਸਾਡੇ ਖੇਤਰ ਦੀ ਜੇਕਰ ਗੱਲ ਕਰੀਏ ਪ੍ਰਮੁੱਖ ਧਾਰਮਿਕ ਪਰੰਪਰਾਵਾਂ ਰੀਤੀ ਰਿਵਾਜ਼ਾਂ ਨੇ ਜੋ ਉਹ ਇੱਕ ਗੁਰਮੱਤ ਦੇ ਅਨੁਸਾਰ ਜਿੱਦਾਂ ਕਿ ਨਗਰ ਕੀਰਤਨ ਕੱਢਣੇ ਦੀਵਾਣ ਲਗਾਉਣੇ ਅਤੇ ਤੀਰਥ ਯਾਤਰਾਵਾਂ ਦੀ ਗੱਲ ਕਰੀਏ ਤਾਂ ਇਕੱਠੇ ਹੋ ਕੇ ਇੱਕ ਇੱਕ ਹੀ ਤੀਰਥ ਯਾਤਰਾ 'ਤੇ ਜਿੱਦਾਂ ਕਿ ਅਨੰਦਪੁਰ ਸਾਹਿਬ ਹਜੂਰ ਸਾਹਿਬ ਜਾਂ ਫਿਰ ਹੇਮਕੁੰਟ ਦੀ ਯਾਤਰਾ ਇਹ ਸਭ ਕੁਛ ਸਾਡੇ ਜੋ ਖੇਤਰ ਦੇ ਧਾਰਮਿਕ ਅਭਿਆਸਾਂ ਦਾ ਇੱਕ ਹਿੱਸਾ ਨੇ